ਹਾਂਜੀ ਨਮਸਕਾਰ ਸਰ ਹਾਂਜੀ ਸਰ ਫਾਜ਼ਿਲਕਾ ਗੱਲ ਕਰ ਰਹੇ ਹੋ ਸਰ ਹਾਂਜੀ ਸਰ ਮੈਂ ਨਾ ਇੱਕ ਤਾਂ ਲੋਕਲ ਰੈਜੀਡੈਂਟ ਗੱਲ ਕਰ ਰਿਹਾ ਸੀਗਾ ਹੁਣੇ ਅਸੀਂ ਸ਼ਿਫਟ ਹੋਏ ਸੀਗੇ ਅਤੇ ਸਰ ਮੈਂ ਥੋੜ੍ਹਾ ਟਰੇਨਸ ਬਾਰੇ ਪਤਾ ਕਰਨਾ ਸੀਗਾ ਬਈ ਫਾਜ਼ਲਕਾ ਤੋਂ ਕਿਹੜੀ ਕਿਹੜੀ ਟਰੇਨਜ਼ ਮਤਲਬ ਕਿਹੜੀ ਕਿਹੜੀ ਸਿਟੀ 'ਚ ਕਨੈਕਟਿਵਿਟੀ ਹੈਗੀ ਹੈ ਉਹ ਥੋੜ੍ਹਾ ਪਤਾ ਕਰਨਾ ਸੀਗਾ ਅੱਛਾ ਜੀ ਸਰ ਉਹ ਨਾ ਐਕਚੁਲੀ ਹਾਂਜੀ ਹਾਂਜੀ ਹਾਂਜੀ ਸਰ ਮੈਂ ਤਾਂ ਅੰਮ੍ਰਿਤਸਰ ਵਗੈਰਾ ਵੀ ਜਿਵੇਂ ਮਤਲਬ ਮੇਰੀ ਜਿਹੜੀ ਵਾਈਫ ਹੈ ਉਹ ਉਹਨਾਂ ਨੇ ਸਿੱਖੀ ਧਾਰਨ ਕੀਤੀ ਹੋਈ ਹੈ ਸਰ ਅਤੇ ਉਹ ਅੰਮ੍ਰਿਤਸਰ ਵੀ ਗੇੜਾ ਲੱਗਦਾ ਹੀ ਰਹਿੰਦਾ ਅਤੇ ਵੈਸੇ ਵੈਸੇ ਮੈਂ ਮੇਨ ਮੇਰਾ ਜਿਹੜਾ ਬਿਜ਼ਨਸ ਆ ਉਹ ਦਿੱਲੀ ਦਿੱਲੀ ਹੈ ਅੰਬਾਲਾ ਹੈ ਅਤੇ ਮੇਰਾ ਮੈਂ ਬਿਜਨਸ ਪਰਪਸ ਤੋਂ ਦਿੱਲੀ ਅੰਬਾਲਾ ਵੀ ਜਾਣਾ ਹੁੰਦਾ ਹੈ ਅਤੇ ਮੈਨੂੰ ਇੱਕ ਤਾਂ ਅੰਬਰਸਰ ਦਾ ਦੱਸ ਦਿਓ ਸਰ ਅੰਬਰਸਰ ਅੰਮ੍ਰਿਤਸਰ ਦੀਆਂ ਕਿਹੜੀਆਂ ਕਿਹੜੀਆਂ ਟ੍ਰੇਨਜ਼ ਹੈਗੀਆਂ ਠੀਕ ਹੈ ਅਤੇ ਉਸ ਤੋਂ ਬਾਅਦ ਮਤਲਬ ਮੇਰਾ ਇੱਕ ਆਹ ਦੱਸ ਦਿਓ ਅੰਬਾਲਾ ਯਾ ਦਿੱਲੀ ਦਾ ਅਤੇ ਸਰ ਮੇਰੇ ਜਿਹੜੇ ਸਹੁਰਾ ਪਰਿਵਾਰ ਹੈ ਜਿੱਥੇ ਮੇਰੀ ਮੇਰੀ ਵਾਈਫ ਹੈ ਉਹ ਗੰਗਾ ਨਗਰ ਦੀ ਹੈ ਅਤੇ ਉਧਰ ਵੀ ਦੱਸ ਦਿਓ ਕਈ ਹਾਂਜੀ ਹਾਂਜੀ ਅਤੇ ਮੈਂ ਇੱਕ ਸਰ ਉਧਰ ਵੀ ਜਾਣਾ ਹੁੰਦਾ ਖਾਟੂ ਸ਼ਾਮ ਹਰੇਕ ਅਤੇ ਖਾਟੂ ਸ਼ਾਮ ਵੀ ਜਾਣਾ ਹੁੰਦਾ ਇੱਕ ਖਾਟੂ ਸ਼ਾਮ ਜੇਕਰ ਉਧਰ ਮਤਲਬ ਨੇੜੇ ਤੇੜੇ ਕੋਈ ਸਟੇਸ਼ਨ ਦੀ ਟ੍ਰੇਨ ਹੋਵੇ ਤਾਂ ਮੈਨੂੰ ਦੋ ਤਿੰਨ ਚਾਰ ਪੰਜ ਟ੍ਰੇਨਾਂ ਦੱਸ ਦਿਓ ਪਹਿਲਾਂ ਤਾਂ ਅੰਮ੍ਰਿਤਸਰ ਦਿੱਲੀ ਦੇ ਇੱਕ ਗੰਗਾ ਨਗਰ ਦੀ ਟ੍ਰੇਨ ਦੱਸ ਦਿਓ ਸਰ ਮੈਨੂੰ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਜੀ ਠੀਕ ਐ ਹਾਂਜੀ ਹਾਂਜੀ ਗੰਗਾ ਨਗਰ ਦੀ ਅੱਛਾ ਸਰ ਸਰ ਉਹਦੀ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਹੈ ਸਰ ਠੀਕ ਹੈ ਸਰ ਠੀਕ ਹੈ ਅੱਛਾ ਕੋਈ ਰੈਗੂਲਰ ਮਤਲਬ ਹਫ਼ਤੇ 'ਚ ਦੋ ਤਿੰਨ ਦਿਨ ਵੀ ਹੈਗੀ ਇੱਕ ਦਿਨ ਚੱਲੇਗੀ ਟਰੇਨ ਬਸ ਅੱਛਾ ਅੱਛਾ ਠੀਕ ਹੈ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ ਅਤੇ ਸਰ ਕੋਈ ਠੀਕ ਆ ਸਰ ਕੋਈ ਰਾਜਧਾਨੀ ਟ੍ਰੇਨ ਵਗੈਰਾ ਕੋਈ ਇੱਦਾਂ ਦੀ ਹੋਵੇ ਟਰੇਨ ਕੋਈ ਹੈਗੀ ਆ ਅੱਛਾ ਅੱਛਾ ਰਾਜਧਾਨੀ ਟ੍ਰੇਨ ਕੋਈ ਨਹੀਂ ਹੈਗੀ ਅੱਛਾ ਅੱਛਾ ਠੀਕ ਹੈ ਠੀਕ ਹੈ ਅੱਛਾ ਅੱਛਾ ਮੈਂ ਕਿਹਾ ਚਲੋ ਥੋੜ੍ਹਾ ਸਰ ਉਹ ਹੁੰਦਾ ਨਾ ਚਲੋ ਉਹਦੇ 'ਚ ਥੋੜ੍ਹਾ ਕੰਫਰਟੇਬਲ ਹੋ ਜਾਂਦਾ ਬੰਦਾ ਚਲੋ ਜੇ ਹੁਣ ਮੈਂ ਹੈਗਾ ਮੈਂ ਲਗਭਗ ਹਾਂਜੀ ਅਸੀਂ ਸਿਰਫ ਪਟਿਆਲੇ ਤੋਂ ਸ਼ਿਫਟ ਹੋਏ ਹਾਂ ਇੱਥੇ ਅਤੇ ਮੈਂ ਐਕਚੁਲੀ ਏ ਸੀ ਏ ਸੀ ਕਲਾਸ 'ਚ ਸਫਰ ਕੀਤਾ ਮੈਂ ਤਾਂ ਇਧਰ ਏ ਸੀ ਕਲਾ ਹਾਂ ਇਹਨਾਂ ਇਹਨਾਂ 'ਚ ਏ ਸੀ ਹਾਂ ਇਹਨਾਂ 'ਚ ਏ ਸੀ ਏ ਸੀ ਕਲਾਸ ਹੈਗੇ ਆ ਨਾ ਸਰ ਏ ਸੀ ਕੋਚਿਸ ਹੈਗੇ ਆ ਨਾ ਸਰ ਸਰ ਵਿਦਆਊਟ ਇਹ ਹਾਂਜੀ ਹਾਂ ਹਾਂਜੀ ਵਿਦਆਊਟ ਏ ਸੀ ਕੋਚਿਸ ਸਰ ਸਫਰ ਨਹੀਂ ਹੋ ਪਾਣਾ ਤਾਂ ਕਰਕੇ ਥੋੜ੍ਹਾ ਜਿਹਾ ਪ੍ਰੋਬਲਮਜ਼ ਹੈਗੀਆਂ ਉਹ ਤੋਂ ਫੈਮ ਫੈਮਲੀ ਨਾਲ ਜਾਣਾ ਹੋਵੇ ਨਾ ਜੀ ਠੀਕ ਹੈ ਸਰ ਅੱਛਾ ਅੱਛਾ ਸਰ ਵੈਸੇ ਉਹ ਨਹੀਂ ਹੈਗਾ ਉਹਦੇ 'ਚ ਕੋਈ ਮਤਲਬ ਫੈਮਲੀ ਨਾਲ ਜਾਣਾ ਹੋਵੇ ਕੋਈ ਦਿੱਕਤ ਵਗੈਰਾ ਤਾਂ ਨਹੀਂ ਹੈ ਨਾ ਸਰ ਅੱਛਾ ਟਰੇਨ ਟਰੇਨ ਅੱਛਾ ਅੱਛਾ ਬਸ ਮਤਲਬ ਕੋਈ ਮਤਲਬ ਫੈਮਲੀ ਨਾਲ ਟਰੈਵਲ ਕਰ ਸਕਦੇ ਟਰੇਨ 'ਚ ਕੋਈ ਦਿੱਕਤ ਇੱਦਾਂ ਦੀ ਕੋਈ ਦਿੱਕਤ

ਠੀਕ ਹੈ ਠੀਕ ਹੈ ਸਰ ਥੈਂਕ ਯੂ ਸਰ ਬਹੁਤ ਬਹੁਤ ਮਿਹਰਬਾਨੀ ਇੰਟਰੋਗੇਸ਼ਨ ਦੇਣ ਲਈ ਥੈਂਕ ਯੂ